ਪਹਿਲਾਂ ਕੱਪੜੇ ਪਾਣੀ ਵਿੱਚ ਭਿਉਂ ਕੇ ਅਤੇ ਫਿਰ ਹੱਥ ਨਾਲ ਧੋਂਦੇ ਸੀ ਹੁਣ ਮਸ਼ੀਨ ਨਾਲ ਅਤੇ ਹੱਥਾਂ ਨਾਲ ਧੋਂਦੇ ਹਾਂ ਗਰਮੀਆਂ ਦੇ ਕੱਪੜੇ ਪਤਲੇ ਹੋਣ ਕਰਕੇ ਸਾਨੂੰ ਮਸ਼ੀਨ ਦੀ ਲੋੜ ਨਹੀਂ ਪੈਂਦੀ ਕਿਉਂਕਿ ਧੁੱਪ ਵੀ ਬਹੁਤ ਤੇਜ਼ ਹੁੰਦੀ ਹੈ ਜਲਦੀ ਕੱਪੜੇ ਸੁੱਕ ਜਾਂਦੇ ਨੇ ਸਰਦੀਆਂ ਵਿੱਚ ਕੱਪੜੇ ਮੋਟੇ ਹੋਣ ਕਰਕੇ ਮਸ਼ੀਨ ਦੀ ਲੋੜ ਪੈਂਦੀ ਹੈ ਤਾਂ ਕਿ ਧੋਏ ਅਤੇ ਸੁਕਾਏ ਜਾ ਸਕਣ ਕਿਉਂਕਿ ਧੁੱਪ ਘੱਟ ਹੁੰਦੀ ਹੈ ਤਾਂ ਡਰਾਇਅਰ ਨਾਲ ਸੁਕਾਏ ਕੱਪੜੇ ਥੋੜ੍ਹੀ ਧੁੱਪ ਵਿੱਚ ਜਲਦੀ ਸੁੱਕ ਜਾਂਦੇ ਹਨ ਅੱਜ ਕੱਲ੍ਹ ਮਸ਼ੀਨਾਂ ਨਵੀਂ ਤਕਨੀਕ ਦੀਆਂ ਵੀ ਆ ਗਈਆਂ ਨੇ ਬਹੁਤ ਤੇਜ਼ ਸਟੀਮ ਵਿੱਚ ਕੱਪੜੇ ਧੋਏ ਅਤੇ ਸੁਕਾਏ ਜਾਂਦੇ ਨੇ ਪਰ ਸਾਨੂੰ ਧੁੱਪ ਵਿੱਚ ਸੁਕਾਉਣ ਦੀ ਆਦਤ ਹੋਣ ਕਰਕੇ ਅਸੀਂ ਮਸ਼ੀਨ ਵਿੱਚੋਂ ਕੱਪੜੇ ਕੱਢ ਕੇ ਫਿਰ ਵੀ ਧੁੱਪ ਵਿੱਚ ਸੁਕਾਉਂਦੇ ਹਾਂ ਹੱਥਾਂ ਨਾਲ ਕੱਪੜੇ ਧੋਣ ਦਾ ਫਾਇਦਾ ਇਹ ਹੈ ਕਿ ਕਿਸੇ ਕੱਪੜੇ ਦਾ ਰੰਗ ਉਤਰਦਾ ਹੈ ਤਾਂ ਦੂਸਰੇ ਕੱਪੜੇ ਨੂੰ ਨਹੀਂ ਚੜਦਾ ਮਸ਼ੀਨ ਵਿੱਚ ਧੋਏ ਕੱਪੜਿਆਂ ਵਿੱਚ ਜੇਕਰ ਕਿਸੇ ਇੱਕ ਕੱਪੜੇ ਦਾ ਰੰਗ ਵੀ ਨਿਕਲ ਜਾਵੇ ਤਾਂ ਸਾਰੇ ਕੱਪੜੇ ਖਰਾਬ ਹੋ ਜਾਂਦੇ ਨੇ ਸਾਨੂੰ ਜ਼ਿਆਦਾਤਰ ਕੱਪੜੇ ਹੱਥ ਨਾਲ ਧੋਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇਸ ਨਾਲ ਪਾਣੀ ਅਤੇ ਬਿਜਲੀ ਦੀ ਬਹੁਤ ਬੱਚਤ ਹੁੰਦੀ ਹੈ ਅਤੇ ਸਾਡੇ ਸਰੀਰ ਦੀ ਐਕਸਰਸਾਈਜ਼ ਵੀ ਹੁੰਦੀ ਹੈ ਅਸੀਂ ਬਹੁਤ ਬਿਮਾਰੀਆਂ ਤੋਂ ਬਚ ਸਕਦੇ ਹਾਂ ਪਰ ਸਰਵਿਸ ਕਰਨ ਵਾਲੀਆਂ ਔਰਤਾਂ ਕੋਲ ਟਾਈਮ ਬਹੁਤ ਘੱਟ ਹੁੰਦਾ ਹੈ ਉਹਨਾਂ ਕੋਲ ਤਾਂ ਮਸ਼ੀਨ ਦਾ ਹੀ ਇੱਕ ਸਹਾਰਾ ਹੈ ਜਾਂ ਫਿਰ ਮੇਡ ਰੱਖਣੀ ਪੈਂਦੀ ਹੈ ਪਰ ਮੇਰੀ ਕੋਸ਼ਿਸ਼ ਇਹੀ ਰਹਿੰਦੀ ਹੈ ਕਿ ਮੈਂ ਕੱਪੜੇ ਹੱਥ ਨਾਲ ਧੋਵਾਂ ਤਾਂ ਕਿ ਕੁਦਰਤੀ ਸਰੋਤ ਪਾਣੀ ਨੂੰ ਬਚਾਇਆ ਜਾ ਸਕੇ ਬਾਕੀ ਅੱਜ ਕੱਲ੍ਹ ਕੱਪੜੇ ਬਹੁਤ ਮਹਿੰਗੇ ਹੁੰਦੇ ਨੇ ਇਸ ਕਰਕੇ ਵੀ ਸਾਨੂੰ ਹੱਥ ਨਾਲ ਧੋਣੇ ਚਾਹੀਦੇ ਨੇ